ਵਿਆਹ ਸ਼ਾਦੀ ਵਿੱਚ ਸਾਨੂੰ ਢੋਲਕੀ ਅਤੇ ਸਾਜ਼ 'ਤੇ ਗਾਣਾ ਗਾਉਣਾ ਪਸੰਦ ਹਨ ਵਿਆਹ ਵਿੱਚ ਅਸੀਂ ਘੋੜੀਆਂ ਅਤੇ ਸੁਹਾਗ ਢੋਲਕੀ ਨਾਲ ਗਾਉਂਦੇ ਹਾਂ ਅਤੇ ਜਾਗੋ ਵਿੱਚ ਬੋਲੀਆਂ ਪਾ ਕੇ ਨੱਚਦੇ ਹਾਂ ਅਤੇ ਅਤੇ ਉਸਦੇ ਉੱਤੇ ਚਮਚੀ ਨਾਲ ਚਮਚੇ ਨਾਲ ਅਸੀਂ ਢੋਲਕੀ 'ਤੇ ਚਮਚੇ ਨਾਲ ਵਜਾਉਂਦੇ ਹਾਂ ਉਸ ਵਿੱਚੋਂ ਵਧੀਆ ਆਵਾਜ਼ ਆਉਂਦੀ ਹੈ ਗੁਰਦੁਆਰੇ ਵਿੱਚ ਅਸੀਂ ਗੁਰਦੁਆਰੇ ਵਿੱਚ ਅਸੀਂ ਤਬਲੇ 'ਤੇ ਸ਼ਬਦ ਗਾਉਂਦੇ ਹਾਂ ਅਤੇ ਨਾਲ ਚਿੰਤਾ ਚਿਮਟਾ ਵਜਾਉਂਦੇ ਹਾਂ ਗੁਰਬਾਣੀ ਦੇ ਸ਼ਬਦ ਪੜ੍ਹਦੇ ਹਾਂ ਸਕੂਲ ਵਿੱਚ ਸਾਨੂੰ ਸਕੂਲ ਵਿੱਚ ਸਾਨੂੰ ਗੁਰਬਾਣੀ ਦੇ ਤਬਲੇ 'ਤੇ ਗੁਰਬਾਣੀ ਪੜ੍ਹਨ ਦਾ ਸ਼ਬਦ ਪੜ੍ਹਨਾ ਸਿਖਾਉਂਦੇ ਸਨ ਸ਼ਬਦ ਸਾਨੂੰ ਤਬਲੇ ਨਾਲ ਸ਼ਬਦ ਸਾਨੂੰ ਬਹੁਤ ਵਧੀਆ ਲੱਗਦੇ ਹਨ ਅਤੇ ਬਹੁਤ ਮਿੱਠੀ ਵਧੀਆ ਆਵਾਜ਼ ਆਉਂਦੀ ਹੈ ਇਸ ਕਰਕੇ ਸਾਨੂੰ ਵਾਜਿਆ ਬਾਜੇ 'ਤੇ ਗਾਉਣਾ ਢ ਢੋਲਕੀ 'ਤੇ ਵਜਾਉਣਾ ਤਬਲੇ 'ਤੇ ਅਤੇ ਸਾਜ਼ਾਂ 'ਤੇ ਗਾਉਣਾ ਬਹੁਤ ਪਸੰਦ ਹੈ ਇਸ ਪਸੰਦ ਹੈ ਹਰ ਇੱਕ ਪ੍ਰੋਗਰਾਮ ਵਿੱਚ ਅਸੀਂ ਇਸ ਤਰ੍ਹਾਂ ਆਪਣਾ ਸ਼ੌਂਕ ਮਨੋਰੰਜਨ ਪੂਰਾ ਕਰਦੇ ਹਾਂ ਇਸ ਨਾਲ ਸਾਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ ਅਤੇ ਚੰਗਾ ਵੀ ਲੱਗਦਾ ਹੈ